ਮੈਂ ਪਿਛਲੇ ਮਹੀਨੇ ਬੋਟ ਕੰਪਨੀ ਦੇ ਹੈਡਫੋਨ ਖਰੀਦੇ ਸੀ ਜੋ ਬਹੁਤ ਵਧੀਆ ਚੱਲ ਰਹੇ ਨੇ ਇਹਨਾਂ ਦੀ ਆਵਾਜ਼ ਕੁਆਲਿਟੀ ਬਹੁਤ ਹੀ ਸ਼ਾਨਦਾਰ ਹੈ ਮੈਨੂੰ ਕਾਫੀ ਇਹਨਾਂ ਇਸ ਪ੍ਰੋਡਕਟ 'ਤੇ ਡਿਸਕਾਊਂਟ ਵੀ ਮਿਲ ਗਿਆ ਅਤੇ ਮੈਨੂੰ ਜਦੋਂ ਵੀ ਮੈਂ ਇਹ ਹੈਡਫੋਨ ਕੰਨ 'ਤੇ ਲਾਉਂਦਾ ਹਾਂ ਤਾਂ ਮੈਨੂੰ ਇਹ ਇਹਨਾਂ ਦੀ ਸਾਊਂਡ ਕੁਆਲਿਟੀ ਬਹੁਤ ਅੱਛੀ ਲੱਗਦੀ ਹੈ ਬੋਟ ਕੰਪਨੀ ਬਾਰੇ ਸੁਣਿਆ ਸੀ ਵੀ ਇਹਨਾਂ ਦੀ ਜਿਹੜੀ ਸਾਊਂਡ ਕੁਆਲਿਟੀ ਹੈ ਉਹ ਬਹੁਤ ਅੱਛੀ ਹੁੰਦੀ ਹੈ ਇਹਨਾਂ ਦੇ ਪ੍ਰੋਡਕਟ ਜਿਹੜੇ ਹੈਗੇ ਅੱਛੇ ਹੈਗੇ ਹੈ ਇਹਨਾਂ ਦੇ ਜਿਹੜੇ ਹੈਡਫੋਨ ਹੈਗੇ ਹੈ ਉਹ ਉੱਚ ਕੁਆਲਿਟੀ ਦੇ ਹੁੰਦੇ ਹਨ ਮੈਨੂੰ ਮੇਰੇ ਦੋਸਤ ਨੇ ਇਸ ਬਾਰੇ ਦੱਸਿਆ ਸੀ ਕਿ ਤੁਸੀਂ ਜੇ ਕਰ ਮੋਬਾਇਲ ਫ਼ੋਨ ਵਾਸਤੇ ਹੈਡਫੋਨ ਲੈਣੇ ਆ ਤਾਂ ਤੁਸੀਂ ਬੋਟ ਕੰਪਨੀ ਦੇ ਲਿਓ ਮੈਂ ਉਹਨਾਂ ਦੀ ਗੱਲ ਤੇ ਅਸਰ ਕਰਦੇ ਹੋਏ ਬੋਟ ਕੰਪਨੀ ਦੇ ਹੈਡਫੋਨ ਖਰੀਦੇ ਮੈਨੂੰ ਇਸ 'ਤੇ ਬੜੀ ਤਸੱਲੀ ਹੋਈ ਵੀ ਇਹ ਪ੍ਰੋਡਕਟ ਮੈਂ ਬਹੁਤ ਚੰਗਾ ਲਿਆ ਅਤੇ ਮੈਨੂੰ ਇਸ ਪ੍ਰੋਡਕਟ 'ਤੇ ਬਹੁਤ ਚੰਗਾ ਲੱਗ ਰਿਹਾ ਹੈ ਬੋਟ ਕੰਪਨੀ ਦਾ ਖਰੀਦ ਕੇ ਧੰਨਵਾਦ ਜੀ